ਸਾਡੇ ਖੇਤਰ ਵਿੱਚ ਡਾਕਟਰ ਬਹੁਤ ਘੱਟ ਹਨ ਜਿਵੇਂ ਕਿ ਪਿੰਡਾਂ ਵਿੱਚ ਆਰ ਐਮ ਪੀ ਡਾਕਟਰ ਹੀ ਹੁੰਦੇ ਹਨ ਜੋ ਕਿ ਮੁੱਢਲੀ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਬਹੁਤ ਘੱਟ ਸਰਕਾਰੀ ਹਸਪਤਾਲ ਹਨ ਜਿੱਥੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਸ ਜਿਵੇਂ ਕਿ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਅਤੇ ਡਾਕਟਰਾਂ ਦੀ ਘੱਟ ਘੱਟ ਹੁੰਦੇ ਹਨ ਡਾਕਟਰ ਵੀ ਘੱਟ ਹੁੰਦੇ ਹਨ ਸਾਡਾ ਪੇਂਡੂ ਖੇਤਰ ਹੋਣ ਕਰਕੇ ਇੱਥੇ ਮੈਡੀਕਲ ਜਾਂ ਨਰਸਿੰਗ ਦੇ ਵਿੱਦਿਅਕ ਅਦਾਰੇ ਘੱਟ ਹਨ ਇਸ ਕਰਕੇ ਸਾਨੂੰ ਡਾਕਟਰ ਦੀ ਪੜ੍ਹਾਈ ਕਰਨ ਵਾਸਤੇ ਆਪਣੇ ਖੇਤਰ ਤੋਂ ਬਾਹਰ ਵੀ ਜਾਣਾ ਪੈਂਦਾ ਹੈ ਅਤੇ ਜ਼ਿਆਦਾਤਰ ਤਾਂ ਮੈਡੀਕਲ ਜਾਂ ਨਰਸਿੰਗ ਕਾਲਜ ਸ਼ਹਿਰਾਂ ਵਿੱਚ ਹੀ ਹੁੰਦੇ ਹਨ ਕਈ ਵਾਰ ਤਾਂ ਸਾਨੂੰ ਕਾਲਜ ਵਿੱਚ ਸੀਟ ਹੀ ਨਾ ਮਿਲਣ ਕਰਕੇ ਪੰਜਾਬ ਦੇ ਬਾਹਰ ਦੂਸਰੇ ਰਾਜਾਂ ਵਿੱਚ ਵੀ ਆਪਣੀ ਪੜ੍ਹਾਈ ਵਾਸਤੇ ਜਾਣਾ ਪੈਂਦਾ ਹੈ ਅਤੇ ਕਈ ਵਾਰ ਸਾਡੇ ਖੇਤਰ ਦੇ ਲੋਕ ਦੂਸਰੇ ਦੇਸ਼ਾਂ ਵਿੱਚ ਅਮਰੀਕਾ ਕਨੇਡਾ ਇੰਗਲੈਂਡ ਆਸਟਰੇਲੀਆ ਯੂਕੈਰਨ ਨਿਊਜ਼ੀਲੈਂਡ ਕੇਰਲਾ ਆਦਿ ਦੇਸ਼ਾਂ ਵਿੱਚ ਵੀ ਪੜ੍ਹਾਈ ਲਈ ਜਾਂਦੇ ਹਨ ਅਤੇ ਡਾਕਟਰ ਬਣ ਕੇ ਆਪਣੇ ਖੇਤਰ ਦਾ ਨਾਮ ਰੌਸ਼ਨ ਕਰਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਪੁੱਤਰ ਸਾਡੇ ਖੇਤਰ ਵਿੱਚ ਵੱਧ ਤੋਂ ਵੱਧ ਮੈਡੀਕਲ ਕਾਲਜ ਖੋਲ੍ਹੇ ਜਾਣ ਤਾਂ ਕਿ ਸਾਡੇ ਖੇਤਰ ਦੇ ਲੋਕ ਇੱਥੇ ਹੀ ਡਾਕਟਰੀ ਪੜ੍ਹਾਈ ਕਰ ਸਕਣ ਅਤੇ ਆਪਣੇ ਖੇਤਰ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇ ਸਕਣ